ਮਾਰਸ਼ਲ ਆਰਟ ਭਾਵ ਹੈ ਨਾ ਇਹ ਆਮ ਤੌਰ 'ਤੇ ਸਾਡੇ ਸਮਾਜ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਚਲਾਈ ਗਈ ਹੈ ਜੋ ਕਿ ਮਤਲਬ ਕਿ ਇਹ ਲੜਕੀਆਂ ਲਈ ਆਮ ਤੌਰ 'ਤੇ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਇਸ ਵਿੱਚ ਸਾਡੇ ਜਿਹੜੇ ਬਜ਼ੁਰਗ ਹਨ ਮਾਤਾ ਪਿਤਾ ਉਹ ਸਾਨੂੰ ਹੈ ਨਾ ਮਤਲਬ ਇਕੱਲਿਆਂ ਨੂੰ ਅਲਾਓ ਨਹੀਂ ਕਰਦੇ ਬਾਹਰ ਜਾਣਾ ਤਾਂ ਜ ਜੋ ਕਿ ਅੱਜ ਦੇ ਯੁੱਗ ਵਿੱਚ ਨੌਜਵਾਨ ਪੀੜ੍ਹੀ ਆ ਉਹ ਬਹੁਤ ਹੀ ਨਸ਼ੇ ਨਸ਼ਿਆਂ ਦੇ ਰਾਹ 'ਤੇ ਚੱਲ ਪਈ ਆ ਜਾ ਕਿ ਮਤਲਬ ਉਹਨਾਂ ਤੋਂ ਬਚਣ ਲਈ ਸਾਨੂੰ ਮਾਰਸ਼ਲ ਆਰਟ ਦੀ ਸ ਸੁਰੱਖਿਆ ਲੈਣੀ ਚਾਹੀਦੀ ਹੈ ਭਾਵ ਕਿ ਫਿਜ਼ੀਕਲ ਅ ਸ ਸਾਨੂੰ ਕਰਾਟੇ ਜਿਹਨੂੰ ਪੰਜਾਬੀ 'ਚ ਕਹਿੰਦੇ ਕਰਾਟੇ ਸਿੱਖਣੇ ਚਾਹੀਦੇ ਹਨ ਜੋ ਕਿ ਆਮ ਤੌਰ 'ਤੇ ਸ ਮਾਰਸਲ ਆਰਟ ਦੁਆਰਾ ਸਾਨੂੰ ਦੱਸਿਆ ਜਾਂਦਾ ਹੈ ਕਿ ਉਹ ਇੱਕ ਵਿਆ ਵਿਅਕਤੀ ਨੂੰ ਆਮ ਤੌਰ 'ਤੇ ਇਹ ਸਿੱਖ ਸਹੂਲਤਾਂ ਜ਼ਰੂਰ ਲੈਣੀ ਚਾਹੀਦੀ ਹੈ ਅਹ ਮਾਰਸਲ ਆਰਟ ਵਿੱਚ ਆਮ ਤੌਰ 'ਤੇ ਲੜਕੀਆਂ ਨੂੰ ਹੀ ਜ਼ਿਆਦਾ ਸਹੂਲਤ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਅੱਜ ਦੇ ਯੁਗ ਵਿੱਚ ਨਵੀਂ ਪੀੜ੍ਹੀ ਦੇ ਹੋਣ ਕਾਰਨ ਹੀ ਬਹੁਤ ਹੀ ਅੱਤਿਆਚਾਰ ਦੇ ਭਾਵ ਅੱਤਿਆਚਾਰ ਲੜਾਈਆਂ ਭਾਵ ਹੋਰ ਬਹੁਤ ਸਾਰੇ ਮਤਲਬ ਗੱਲਾਂ ਆਮ ਤੌਰ 'ਤੇ ਫੈਲ ਰਹੀਆਂ ਹਨ ਸਾਡੇ ਬਜ਼ੁਰਗ ਮਾਤਾ ਪਿਤਾ ਸਾਨੂੰ ਇਕੱਲੀਆਂ ਕੁੜੀਆਂ ਨੂੰ ਬਾਹਰ ਜਾਣਾ ਅਲੋਅ ਨਹੀਂ ਕਰਦੇ ਜਿਸ ਕਾਰਨ ਮਰਸ਼ਲ ਆਰਟ ਜਾਂ ਆਮ ਤੌਰ 'ਤੇ ਸਾਡੇ ਸਰਕਾ ਹ ਅਹ ਸਾਡੇ ਬਜ਼ੁਰਗਾਂ ਨੇ ਸਾਨੂੰ ਆਮ ਤੌਰ 'ਤੇ ਇਹ ਸੁਰੱਖਿਆ ਨੂੰ ਪ੍ਰਦਾਨ ਕਰਨ ਲਈ ਬਹੁਤ ਹੀ ਮਹਤੱਵ ਦਿੱਤੀ ਇਸ ਲਈ ਹਰੇਕ ਵਿਅਕਤੀ ਨੂੰ ਮਤਲਬ ਭਾਵ ਲੜਕੀਆਂ ਨੂੰ ਨਹੀਂ ਲੜਕਿਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹਮੇਸ਼ਾ ਉਸਨੂੰ ਸਰੀਰਕ ਢੰਗ ਨਾਲ ਮਜਬੂਤ ਰਹਿਣਾ ਚਾਹੀਦੇ ਜੋ ਕਿ ਅੱਗਿਓਂ ਲੜਨ ਦੀ ਭਾਵਨਾ ਅਤੇ ਹਿੰਮਤ ਵਿੱਚ ਨੇੜਤਾ ਪੈਦਾ ਕਰ ਸਕਣ